ਅੱਜ ਕੱਲ੍ਹ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਫੇਸਬੁੱਕ ਯੂਟਿਊਬ ਟਿਕਟੌਕ ਇੰਸਟਾਗਰਾਮ ਵਟਸਐਪ ਸਨੈਪਚੈਟ ਗੁਰਬਾਣੀ ਸਟੀ ਇਹਦੇ ਵਿੱਚ ਆਪਾਂ ਨੂੰ ਸ ਆਹ ਵਟਸ ਵਟ ਵਟਸਐਪ 'ਤੇ ਆਪਾਂ ਨੂੰ ਇਸਟਾਗ ਫੇਸਬੁੱਕ 'ਤੇ ਆਪਾਂ ਨੂੰ ਮਤਲਬ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ ਜਿਵੇਂ ਕਿ ਆਪਾਂ ਨੂੰ ਦੁਨੀਆਂ ਵਿੱਚ ਕੋਈ ਵੀ ਜਾਣਕਾਰੀ ਮਿਲ ਸਕਦੀ ਹੈ ਅੱਜ ਕੱਲ੍ਹ ਇਹਨਾਂ ਦੇ ਫ਼ਾਇਦੇ ਬਹੁਤ ਹਨ ਜਿਵੇਂ ਕਿ ਆਪਾਂ ਸ ਇਹ ਬਿੱਲ ਵੀ ਪੇ ਕਰ ਸਕਦੇ ਹਾਂ ਪੈਸੇ ਵੀ ਪੇ ਕਰ ਸਕਦੇ ਹਾਂ ਲਾਇਸੈਂਸ ਵੀ ਬਣਾ ਸਕਦੇ ਹਾਂ ਜਿਵੇਂ ਕਿ ਪੜ੍ਹਾਈ ਵੀ ਕਰ ਸਕਦੇ ਹਾਂ ਆਧਾਰ ਕਾਰਡ ਵੀ ਬਣਵਾ ਸਕਦੇ ਹਾਂ ਅਤੇ ਹੋਰ ਵੀ ਆਪਾਂ ਨੂੰ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਕਿ ਆਪਾਂ ਇੱਕ ਜਿਵੇਂ ਕਿ ਆਪਾਂ ਕਿਤ ਕੋਈ ਵੀ ਖਾਣਾ ਬਣਾਉਣਾ ਹੋਵੇ ਉਹ ਵੀ ਆਪਾਂ ਐਪ ਡਾਊਨਲੋਡ ਕਰਕੇ ਆਪਾਂ ਇਹ ਮਤਲਬ ਕਿ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਨੂੰ ਇੰਸਟਾਗਰਾਮ 'ਤੇ ਵੀ ਬਹੁਤ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਫਿਲਮਾਂ ਫਿਲਮਾਂ ਖਾਣੇ ਗਾਣੇ ਆਪਾਂ ਸਾਰਾ ਕੁਝ ਇੰਸਟਾਗਰਾਮ 'ਤੇ ਹੀ ਵੇਖ ਸਕਦੇ ਹਾਂ ਇਸ ਤੋਂ ਇਲਾਵਾ ਆਪਣੇ ਫੋਨ ਦੇ ਨੁਕਸਾਨ ਨੁਕਸਾਨ ਇਹ ਹਨ ਕਿ ਜਿਵੇਂ ਕਿ ਬੱਚਿਆਂ ਲਈ ਬਹੁਤ ਹੀ ਨੁਕਸਾਨਦਾਇਕ ਹੈ ਨਾ ਬੱਚੇ ਫੋਨ ਜ਼ਿਆਦਾਤਰ ਨਹੀਂ ਵੇਖ ਸਕਦੇ ਉਹਨਾਂ ਨੂੰ ਅੱਖਾਂ 'ਤੇ ਬਹੁਤ ਹੀ ਹਾਨੀਕਾਰਕ ਹੈ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਖਰਾਬ ਹੋ ਸਕਦੀ ਹੈ ਇਸ ਤੋਂ ਇਲਾਵਾ ਕਿ ਆਪਾਂ ਨੇ ਬਹੁਤ ਹੀ ਬੱਚਿਆਂ ਵਾਸਤੇ ਨੁਕਸਾਨਦਾਇਕ ਹੈ ਆਪਣੇ ਵਾਸਤੇ ਫ਼ਾਇਦੇਮੰਦ ਹਨ